ਸਾਡੇ ਪਿੰਡ ਦੇ ਨਾਲ ਦੇ ਪਿੰਡ ਬਾਜਕ ਵਿਖੇ ਇੱਕ ਗੁਰਦੁਆਰਾ ਹੈ ਇਹ ਗੁਰਦੁਆਰਾ ਬਹੁਤ ਇਤਿਹਾਸਿਕ ਗੁਰਦੁਆਰਾ ਹੈ ਇਹ ਗੁਰਦੁਆਰੇ ਦਾ ਇਤਿਹਾਸ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੋਇਆ ਹੈ ਅਤੇ ਇਸ ਸਥਾਨ 'ਤੇ ਜਾ ਕੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਜਦੋਂ ਵੀ ਅਸੀਂ ਇਸ ਧਾਰਮਿਕ ਸਥਾਨ 'ਤੇ ਜਾਂਦੇ ਹਾਂ ਤਾਂ ਬਹੁਤ ਹੀ ਜ਼ਿਆਦਾ ਆਨੰਦ ਮਿਲਦਾ ਹੈ ਅਤੇ ਇਹ ਸਾਥੋਂ ਕੁਛ ਪੰਜ ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਜਦੋਂ ਵੀ ਮੈਂ ਕਈ ਵਾਰ ਸ਼ਾਮ ਨੂੰ ਵਿਹਲਾ ਹੁੰਦਾ ਹਾਂ ਜਾਂ ਫਿਰ ਕਿਸੇ ਦਿਨ ਛੁੱਟੀ ਹੁੰਦੀ ਹੈ ਤਾਂ ਮੈਂ ਅਕਸਰ ਹੀ ਇੱਥੇ ਜਾਂਦਾ ਹਾਂ ਅਤੇ ਇੱਥੇ ਬਹੁਤ ਜ਼ਿਆਦਾ ਵਧੀਆ ਗੁਰਮਤਿ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਇੱਥੇ ਕਈ ਤਰ੍ਹਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਅਤੇ ਹੋਰ ਜਿਵੇਂ ਗੱਤਕਾ ਸਿਖਲਾਈ ਅਤੇ ਪਾਠ ਵੀ ਸਿਖਾਇਆ ਜਾਂਦਾ ਹੈ ਅਤੇ ਮੈਂ ਇੱਥੇ ਕਈ ਵਾਰ ਜਦੋਂ ਸ਼ਾਮ ਨੂੰ ਕਲਾਸ ਲਾਉਣ ਜਾਂਦਾ ਹਾਂ ਤਾਂ ਮੈਂ ਇੱਥੇ ਪਾਠ ਸਿੱਖਦਾ ਹਾਂ ਅਤੇ ਮੈਂ ਗੱਤਕਾ ਵੀ ਸਿੱਖਦਾ ਹਾਂ ਜਦੋਂ ਮੈਂ ਐਤਵਾਰ ਨੂੰ ਜਾਂਦਾ ਹਾਂ ਉਦੋਂ ਗੱਤਕਾ ਦੀ ਕਲਾਸ ਲੱਗਦੀ ਹੈ ਅਤੇ ਉੱਥੇ ਮੈਂ ਗੱਤਕਾ ਸਿੱਖਦਾ ਹਾਂ ਅਤੇ ਇਹਦੇ ਨਾਲ ਨਾਲ ਹੋਰ ਵੀ ਕਈ ਜਿਹੜੀਆਂ ਧਾਰਮਿਕ ਗਤੀਵਿਧੀਆਂ ਜਿਹੜੀਆਂ ਇਸ ਗੁਰਦੁਆਰਾ ਸਾਹਿਬ ਵਿਖੇ ਕਰਵਾਈਆਂ ਜਾਂਦੀਆਂ ਹਨ ਅਤੇ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ ਅਤੇ ਜਦੋਂ ਵੀ ਮੈਂ ਫ੍ਰੀ ਹੁੰਦਾ ਹਾਂ ਤਾਂ ਮੈਂ ਇਸ ਨੇੜਲੇ ਪਿੰਡ ਗੁਰਦੁਆਰੇ ਜਾ ਕੇ ਦਰਸ਼ਨ ਕਰਦਾ ਹਾਂ ਅਤੇ ਜਦੋਂ ਮੈਂ ਇੱਥੇ ਪਾਠ ਕਰਦਾ ਹਾਂ ਤਾਂ ਇੱਥੇ ਬਹੁਤ ਜ਼ਿਆਦਾ ਸ਼ਾਂਤੀ ਹੁੰਦੀ ਹੈ ਅਤੇ ਮੈਨੂੰ ਬਹੁਤ ਜ਼ਿਆਦਾ ਆਨੰਦ ਮਿਲਦਾ ਹੈ ਅਤੇ ਨਾਲ ਦੀ ਨਾਲ ਜੋ ਗੱਤਕਾ ਕਲਾਸਿਸ ਹੁੰਦੀਆਂ ਹਨ ਤਾਂ ਗੱਤਕਾ ਕਲਾਸ ਦੇ ਵਿੱਚ ਵੀ ਮੈਨੂੰ ਬਹੁਤ ਮਜ਼ਾ ਆਉਂਦਾ ਹੈ